ਮੈਨੂੰ ਤੈਰਾਕੀ ਦਾ ਕੋਈ ਬਹੁਤਾ ਸ਼ੌਕ ਨਹੀਂ ਹੈ ਪਰ ਫਿਰ ਵੀ ਸਾਡੇ ਖੇਤਰ ਦੇ ਵਿੱਚ ਅਪੋਲੋ ਗਰਾਊਂਡ ਦੇ ਵਿੱਚ ਜਿਹੜਾ ਇਹ ਤੈਰਾਕੀ ਦਾ ਇੱਕ ਜਿਹੜਾ ਹੈ ਉਹ ਜ਼ਰੀਆ ਜਾਂ ਇੱਕ ਸਰੋਤ ਬਣਿਆ ਹੋਇਆ ਹੈ ਪਰ ਮੈਂ ਕਿਤੇ ਵੀ ਕਦੇ ਵੀ ਕੋਈ ਤੈਰਾਕੀ ਨਹੀਂ ਕੀਤੀ ਮੇਰਾ ਇਸ ਤਰ੍ਹਾਂ ਦਾ ਕੋਈ ਤਜ਼ਰਬਾ ਨਹੀਂ ਹੈ